ਜਿਵੇਂ ਕਿ ਮੈਨੂੰ ਯਾਤਰਾ ਕਰਨ ਦਾ ਘੁੰਮਣ ਫਿਰਨ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਅਤੇ ਮੈਂ ਬਹੁਤ ਜ਼ਿਆਦਾ ਘੁੰਮਦੀ ਫਿਰਦੀ ਹਾਂ ਬਹੁਤ ਹੀ ਜ਼ਿਆਦਾ ਟੂਰ ਕੱਢਦੀ ਹਾਂ ਮਹੀਨੇ 'ਚ ਇੱਕ ਅੱਧੀ ਵਾਰ ਜ਼ਾਂ ਦੋ ਮਹੀਨੇ ਬਾਅਦ ਮੈਂ ਯਾਤਰਾ ਕਰ ਹੀ ਲੈਂਦੀ ਹਾਂ ਪਰ ਇਹ ਨਾ ਯਾਤਰਾ ਦੇ ਦੌਰਾਨ ਕਈ ਸਾਰੀਆਂ ਚੁਣੌਤੀਆਂ ਵੀ ਹਨ ਜਿਹਨਾਂ ਦਾ ਮੈਂ ਸਾਹਮਣਾ ਕਰਦੀ ਹਾਂ ਯਾਤਰਾ ਦੇ ਦੌਰਾਨ ਜਿਵੇਂ ਕਿ ਅਗਰ ਮੈਂ ਪੰਜਾਬ 'ਚ ਹੀ ਗੱਲ ਕਰਾਂ ਅਗਰ ਪੰਜਾਬ 'ਚ ਕਿਤੇ ਜਾਵਾਂ ਤਾਂ ਮੈਨੂੰ ਬਹੁਤੀ ਜ਼ਿਆਦਾ ਔਖੀ ਨਹੀਂ ਹੁੰਦੀ ਕਿਉਂਕਿ ਪੰਜਾਬ ਦਾ ਜੋ ਇਲਾਕਾ ਹੈ ਜ਼ਿਆਦਾਤਰ ਹਰ ਹਰ ਜਗ੍ਹਾ ਇੱਕੋ ਜਿਹਾ ਹੀ ਮੰਨਿਆ ਜਾਂਦਾ ਹੈ ਜ਼ਿਆਦਾਤਰ ਰਹਿਣ ਸਹਿਣ ਦੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਪਰ ਅਗਰ ਮੈਂ ਗੱਲ ਕਰਾਂ ਪੰਜਾਬ ਤੋਂ ਬਾਹਰ ਅਗਰ ਮੈਂ ਪੰਜਾਬ ਤੋਂ ਬਾਹਰ ਕਿਤੇ ਜਾਂਦੀ ਹਾਂ ਜਾਂ ਹਿਮਾਚਲ ਜਾਂ ਕਿਤੇ ਵੀ ਹੋਰ ਏਰੀਏ 'ਚ ਜ਼ਿਆਦਾਤਰ ਤਾਂ ਮੈਂ ਹਿਮਾਚਲ ਪ੍ਰਦੇਸ਼ ਵਿੱਚ ਘੁੰਮ ਚੁੱਕੀ ਹਾਂ ਉੱਥੇ ਮਤਲਬ ਕਿ ਧਰਮਸ਼ਾਲਾ ਡਲਹੋਜ਼ੀ ਵਗੈਰਾ ਇਲਾਕੇ ਵਿੱਚ ਜਾ ਚੁੱਕੀ ਹਾਂ ਜ਼ਿਆਦਾ ਜੋ ਮੇਨ ਦਿੱਕਤਾਂ ਜੋ ਮੈਂ ਮੇਨ ਚੁਣੌਤੀਆਂ ਸਾਹਮਣੇ ਜੋ ਆਈਆਂ ਹਨ ਜਿਨ੍ਹਾਂ ਦਾ ਮੈਂ ਸਾਹਮਣਾ ਕੀਤਾ ਹੈ ਸਭ ਤੋਂ ਪਹਿਲੀ ਇਹ ਹੈ ਕਿ ਰੈਸਟ ਰੂਮ ਵਗੈਰਾ ਰੈਸਟ ਰੂਮ ਮਤਲਬ ਕਿ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਮੈਨੂੰ ਕਈ ਵਾਰ ਰਹਿਣ ਸਹਿਣ ਦੀ ਕਾਫੀ ਦਿੱਕਤ ਆਈ ਹੈ ਪਹਿਲਾਂ ਤਾਂ ਰੈਸਟ ਰੂਮ ਲੱਭਣਾ ਹੀ ਬਹੁਤ ਮੁਸ਼ਕਿਲ ਹੁੰਦਾ ਹੈ ਉੱਥੇ ਜਾ ਕੇ ਅਸੀਂ ਘੁੰਮਣ ਫਿਰਨ ਜਾਂਦੇ ਹਾਂ ਉੱਥੇ ਰੈਸਟ ਰੂਮ ਲੱਭਣਾ ਅਤੇ ਦੇਖਣਾ ਵੀ ਕੀ ਉਹ ਸਾਡੇ ਲਈ ਸਹੀ ਵੀ ਹੈ ਜਾਂ ਨਹੀਂ ਉੱਥੇ ਕੀ ਕੀ ਸਾਨੂੰ ਸਹੂਲਤਾਂ ਮਿਲਦੀਆਂ ਹਨ ਰੈਸਟ ਰੂਮ ਵਿੱਚ ਉਹ ਸਾਰਾ ਦੇਖਣਾ ਪੈਂਦਾ ਹੈ ਦੂਜੇ ਨੰਬਰ 'ਤੇ ਇਹ ਹੈ ਕਿ ਭੋਜਨ ਦੀ ਗੱਲ ਕੀਤੀ ਜਾਵੇ ਤਾਂ ਭੋਜਨ ਪੰਜਾਬ ਵਿੱਚ ਤਾਂ ਫਿਰ ਵੀ ਅਸੀਂ ਪੰਜਾਬੀ ਖਾਣਾ ਖਾ ਲੈਂਦੇ ਹਾਂ ਅਗਰ ਪੰਜਾਬ ਤੋਂ ਬਾਹਰ ਜਾਇਆ ਜਾਵੇ ਹਿਮਾਚਲ ਪ੍ਰਦੇਸ਼ ਵਗੈਰਾ ਇੱਕ ਤਾਂ ਉੱਥੇ ਖਾਣਾ ਮਹਿੰਗਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਉੱਤੋਂ ਉੱਥੇ ਉਹ ਗੱਲ ਨਹੀਂ ਬਣਦੀ ਜੋ ਘਰ ਦੀ ਰੋਟੀ ਦੀ ਹੁੰਦੀ ਹੈ ਇਸ ਕਰਕੇ ਭੋਜਨ ਦੀ ਵੀ ਬਹੁਤ ਹੀ ਜ਼ਿਆਦਾ ਦਿੱਕਤ ਜੋ ਹੈ ਇਹ ਚੁਣੌਤੀ ਹੀ ਹੈ ਜੋ ਕਿ ਸਾਹਮਣੇ ਆ ਜਾਂਦੀ ਹੈ ਯੇ ਇਹ ਸਾਰੀਆਂ ਦਿੱਕਤਾਂ ਹਨ ਜਿਹਨਾਂ ਇਹ ਸਾਰੀਆਂ ਚੁਣੌਤੀਆਂ ਜਿਨ੍ਹਾਂ ਨੂੰ ਮੈਂ ਫੇਸ ਕਰ ਚੁੱਕੀ ਹਾਂ